ਹਾਂਜੀ ਮੈਂ ਆਪਣੀ ਐਕਟੀਵਾ ਤੇ ਰੋਜ਼ ਆਪਣੀ ਬੇਟੀ ਨੂੰ ਸਕੂਲ ਛੱਡਣ ਜਾਂਦੀ ਆ ਕਿਉਂਕਿ ਸੁਬਹਾ ਵੇਲੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਮੇਰੀ ਬੇਟੀ ਨਾਲ ਹੁੰਦੀ ਆ ਜਦੋਂ ਮੈਂ ਸ਼ਾਮ ਵੇਲੇ ਆਉਨੀ ਆ ਤੇ ਉਸ ਤੋਂ ਪਹਿਲਾਂ ਦੋ ਵਜੇ ਮੇਰੀ ਬੇਟੀ ਵੈਨ ਤੇ ਚਲੀ ਜਾਂਦੀ ਆ ਉਸ ਤੇ ਸ਼ਾਮ ਨੂੰ ਫਿਰ ਮੈਂ ਇਕੱਲਾ ਹੀ ਆਉਂਦੀ ਆ ਐਕਟੀਵਾ ਤੇ ਫਿਰ ਮੇਰੀ ਕੋਈ ਵੀ ਜਾਂ ਮੇਰੇ ਤੋਂ ਲਿਫਟ ਮੰਗਦਾ ਤੇ ਮੈਂ ਉਹਨੂੰ ਲਿਫਟ ਦੇ ਦਿੰਦੀ ਆਂ ਤੇ ਵੈਸੇ ਤਾਂ ਮੈਂ ਜਾਣ ਪਛਾਣ ਵਾਲੇ ਨੂੰ ਹੀ ਲਿਫਟ ਦਿੰਦੀ ਆਂ ਜੇ ਕੋਈ ਹੋਰ ਹੋਵੇ ਤਾਂ ਮੈਂ ਲਿਫਟ ਨਹੀਂ ਦਿੰਦੀ ਜ਼ਿਆਦਾਤਰ ਕਿਉਂਕਿ ਬਹੁਤ ਥਾਵਾਂ ਤੇ ਫਰੋਡ ਹੋ ਗਿਆ ਹੈ ਤਾਂ ਕਰਕੇ ਇਸ ਤੋਂ ਬਹੁਤ ਡਰ ਲੱਗਦਾ ਹ ਤਾਂ ਕਰਕੇ ਮੈਂ ਜਿਆਦਾਤਰ ਜਾਣ ਪਛਾਣ ਆਲੇ ਤੋਂ ਹੀ ਲਿਫਟ ਦੇ ਦਿੰਦੀ ਆ ਇਸੇ ਕਰਕੇ ਵੀ ਬਜ਼ੁਰਗ ਨੂੰ ਮੈਂ ਲਿਫਟ ਦਿੱਤੀ ਸੀ ਇੱਕ ਨੂੰ ਤੇ ਉਹਨਾਂ ਦੀ ਤਬੀਅਤ ਥੋੜੀ ਜਿਹੀ ਖਰਾਬ ਸੀ ਫਿਰ ਮੈਂ ਆਪਣੀ ਐਕਟਿਵਾ ਤੇ ਉਹਨੂੰ ਹੋਸਪਿਟਲ ਛੱਡਿਆ ਤੇ ਉਹਨੂੰ ਦਵਾਈ ਦਿਖਾ ਕੇ ਫਿਰ ਹੌਲੀ ਹੌਲੀ ਵੀ ਮੈਂ ਉਹਨੂੰ ਘਰੇ ਛੱਡ ਕੇ ਤੇ ਉਹਨੇ ਮੈਨੂੰ ਬਹੁਤ ਅਸੀਸਾ ਦਿੱਤੀਆਂ ਫਿਰ ਮੈਂ ਆਪਣੀ ਬੇਟੀ ਨੂੰ ਰੋਜ ਸਕੂਲ ਛੱਡਣ ਜਾਂਦੀ ਆਂ ਗੱਲਾਂ ਬਾਤਾਂ ਕਰਦੇ ਆ ਆਪਣੀ ਬੇਟੀ ਨੂੰ ਸਕੂਲ ਛੱਡ ਦਿੰਦੀ ਆ ਜਾਂ ਕੋਈ ਹੋਰ ਕੋਈ ਲਿਫਟ ਮੰਗਦਾ ਹੈ ਤੇ ਫਿਰ ਵੀ ਮੈਂ ਲਿਫਟ ਦੇ ਦਿੰਦੀ ਆ ਮੈਂ ਜਿਆਦਾਤਰ ਨਹੀਂ ਲੋਕਾਂ ਨੂੰ ਲਿਫਟ ਦਿੰਦੀ ਇਸ ਕਰਕੇ ਵੀ ਸਾਨੂੰ ਇਹ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਜਾਣ ਪਛਾਣ ਜਾਂ ਹੋਰ ਕੋਈ ਬਜ਼ੁਰਗ ਨੂੰ ਲਿਫਟ ਨਹੀਂ ਦੇਣੀ ਚਾਹੀਦੀ ਐ ਹੋਰ ਕਿਸੇ ਨੂੰ ਜਿਆਦਾਤਰ ਲਿਫਟ ਨਹੀਂ ਦੇਣੀ ਚਾਹੀਦੀ ਕਿਉਂਕਿ ਬਹੁਤ ਥਾਵਾਂ ਤੇ ਫਰੋਡ ਹੋਇਆ ਹੈ ਇਸ ਕਰਕੇ ਵੀ ਸਾਨੂੰ ਦੇਖਣਾ ਚਾਹੀਦਾ ਹੈ ਪਹਿਲਾਂ ਵੀ ਇਹ ਬੰਦਾ ਕਿਹੋ ਜਿਹਾ ਫਿਰ ਹੀ ਲਿਫਟ ਦੇਣੀ ਚਾਹੀਦੀ ਆ